ਆਵਾਜਾਈ ਦੇ ਸਾਧਨਾਂ ਦੇ ਵਿੱਚ ਬੱਸਾਂ ਖਾਸ ਹਨ ਜਿਨ੍ਹਾਂ ਵਿੱਚ ਅਸੀਂ ਦੇਖਦੇ ਹਾਂ ਕਿ ਬੱਸਾਂ ਦੇ ਵਿੱਚ ਕਾਫੀ ਰੱਸ਼ ਹੁੰਦਾ ਹੈ ਜਿਨ੍ਹਾਂ ਨਾਲ ਸਵਾਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਆਉਣ ਜਾਣ ਦੇ ਵਿੱਚ ਅਤੇ ਖੜ੍ਹਨ ਸੀਟਾਂ ਨਹੀਂ ਮਿਲਦੀਆਂ ਹਨ ਅਤੇ ਰੋਡ ਵੀ ਖਰਾਬ ਹਨ ਜਿਨ੍ਹਾਂ ਦਾ ਨਾਲ ਸਵਾਰੀਆਂ ਨੂੰ ਇਹ ਪਰੇਸ਼ਾਨੀ ਆਉਂਦੀ ਆ ਕਿ ਆਪਣੀ ਗੱਡੀ ਖਰਾਬ ਹੁੰਦੀ ਆ ਜੋ ਕੋਈ ਬਾਈਕ 'ਤੇ ਜਾ ਰਿਹਾ ਜਾਂ ਕੋਈ ਬੱਸ 'ਚ ਜਾ ਰਿਹਾ ਤਾਂ ਉਹਨਾਂ ਨੂੰ ਇਹ ਪਰੇਸ਼ਾਨੀ ਆਉਂਦੀ ਆ ਅਤੇ ਹੋਰ ਜੇ ਟ੍ਰੇਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਟ੍ਰੇਨਾਂ ਵੀ ਭਰੀਆਂ ਆਉਂਦੀਆਂ ਅਤੇ ਉਹਨਾਂ ਦੀ ਕੋਈ ਟਾਈਮ ਦਾ ਕੋਈ ਬ ਬਨ ਬੋਨਡੇਜ਼ ਨਹੀਂ ਹੈਗੀ ਕਿ ਉਹ ਟਾਈਮ 'ਤੇ ਆਉਣ ਇਸ ਲਈ ਉਹ ਕਦੀ ਅੱਗੇ ਕਦੀ ਪਿੱਛੇ ਦੋ ਘੰਟੇ ਲੇਟ ਚਾਰ ਘੰਟੇ ਲੇਟ ਇਸ ਤਰ੍ਹਾਂ ਉਹ ਆਉਂਦੀਆਂ ਹਨ